ਪੰਜਾਬ ਇੱਕ ਬਹੁਤ ਹੀ ਅੱਛੀ ਮਾਰਕਿਟ ਏਰੀਆ ਹੈ ਜਿੱਥੇ ਹਰ ਇੱਕ ਤਰ੍ਹਾਂ ਦੇ ਪ੍ਰੋਡਕਟ ਨੂੰ ਸੇਲ ਕੀਤਾ ਜਾ ਸਕਦਾ ਹੈ ਸੋ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਸਪੋਰਟਸ ਇੰਡਸਟਰੀ ਹੋ ਗਈ ਐਗਰੀਕਲਚਰ ਨਾਲ ਰਿਲੇਟਿਡ ਵਪਾਰਕ ਗਤੀਵਿਧੀਆਂ ਹੋ ਗਈਆਂ ਇਸ ਤੋਂ ਇਲਾਵਾ ਪੜ੍ਹਾਈ ਨਾਲ ਰਿਲੇਟਿਡ ਗਤੀਵਿਧੀਆਂ ਹੋ ਗਈਆਂ ਜਾਂ ਫਿਰ ਟੂਰਿਜ਼ਮ ਨਾਲ ਰਿਲੇਟਿਡ ਗਤੀਵਿਧੀਆਂ ਹੋ ਗਈਆਂ ਇਹਨਾਂ ਸਾਰੀਆਂ ਹੀ ਵਪਾਰਕ ਗਤੀਵਿਧੀਆਂ ਨੂੰ ਪੰਜਾਬ ਦੇ ਵਿੱਚ ਫਲਰਇਸ਼ ਕੀਤਾ ਜਾ ਸਕਦਾ ਹੈ ਜਿਹਦੇ ਨਾਲ ਕੀ ਹੈ ਇੱਕ ਇੰਡਸਟਰੀ ਵੀ ਡਿਵੈਲਪ ਹੋਏਗੀ ਅਤੇ ਲੋਕਾਂ ਨੂੰ ਵੀ ਬਹੁਤ ਅੱਛਾ ਸੋਰਸ ਮਿਲੇਗਾ ਆਪਣੀ ਇਨਕਮ ਨੂੰ ਜਨਰੇਟ ਕਰਨ ਦਾ